ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਰਿਤੂ ਬਾਲਾ ਢੇਸੀਆਂ ਤੋਂ ਅਤੇ ਅਸੀਂ ਜਦੋਂ ਬਾਹਰ ਅੰਦਰ ਜਾਂਦੇ ਹਾਂ ਘੁੰਮਣ ਫਿਰਨ ਤਾਂ ਬਾਹਰ ਲੋਕ ਖੁਰ ਕੂੜਾ ਉੱਧਰ ਉੱਧਰ ਸੁੱਟ ਦਿੰਦੇ ਆ ਅਤੇ ਉੱਧਰ ਉੱਧਰ ਕੂੜਾ ਨਹੀਂ ਸੁੱਟਣਾ ਚਾਹੀਦਾ ਸਾਫ ਸਫਾਈ ਰੱਖਣੀ ਚਾਹੀਦੀ ਹੈ ਔਰ ਸਾਫ ਸਫਾਈ ਸਾਡੀ ਸਿਹਤ ਵਾਸਤੇ ਵੀ ਠੀਕ ਹੈ ਅਤੇ ਹੋ ਸਕੇ ਤਾਂ ਕੂੜਾ ਉੱਧਰ ਉੱਧਰ ਨਾ ਸੁੱਟੋ ਹੋ ਸਕੇ ਤਾਂ ਕੂੜਾ ਡਸਟਬੀਨ 'ਚ ਸੁੱਟਣਾ ਚਾਹੀਦਾ ਆ ਅਤੇ ਰਸਤੇ 'ਚ ਨਹੀਂ ਇੱਧਰ ਉੱਧਰ ਸੁੱਟਣਾ ਚਾਹੀਦਾ ਅਤੇ ਸਾਨੂੰ ਸਾਫ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਅਤੇ ਸਾਫ ਸਫਾਈ ਸਾਡੇ ਦੇਸ਼ ਵਿੱਚ ਵੀ ਹੋਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਕੂੜਾ ਇੱਧਰ ਉੱਧਰ ਸੁੱਟਾਂਗੇ ਤਾਂ ਗੰਦਗੀ ਨਾਲ ਕਈ ਬਿਮਾਰੀਆਂ ਵੀ ਫੈਲ ਜਾਂਦੀਆਂ ਇਸ ਲਈ ਸਫਾਈ ਸਾਨੂੰ ਜ਼ਰੂਰ ਰੱਖਣੀ ਚਾਹੀਦੀ ਹੈ ਅਤੇ ਕੂੜਾ ਡਸਟਬੀਨ ਵਿੱਚ ਪਾਉਣਾ ਚਾਹੀਦਾ ਓਕੇ ਸਰ